ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਯੋਗਦਾਨ ਹੈ ਇਹ ਸਰੀਰਕ ਵਿਕਾਸ ਵਿੱਚ ਅਹਿਮ ਹਿੱਸਾ ਪਾਉਂਦੀਆਂ ਹਨ ਇਹ ਸਰੀਰਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਕਰਨ ਵਿੱਚ ਵੀ ਸਹਾਈ ਹੁੰਦੀਆਂ ਹਨ ਪੇਂਡੂ ਇਹ ਇੱਕ ਇਹ ਇਹ ਪੇਂਡੂ ਖੇਡਾਂ ਖੁੱਲ੍ਹੇ ਵਾਤਾ ਵਿੱਚ ਵਾਤਾਵਰਨ ਵਿੱਚ ਖੇਡੀਆਂ ਜਾਂਦੀਆਂ ਹਨ ਪੇਂਡੂ ਖੇਡਾਂ ਮੁੰਡਿਆਂ ਦੀਆਂ ਜਿਵੇਂ ਗੁੱਲੀ ਡੰਡਾ ਪਿੱਠੂ ਗਰਮ ਚੋਰ ਸਿਪਾਹੀ ਛੂਣ ਛੁਪਾਈ ਬਾਂਦਰ ਕਿੱਲਾ ਕਬੱਡੀ ਕੁਸ਼ਤੀ ਖੇਡੀਆਂ ਜਾਂਦੀਆਂ ਹਨ ਇਵੇਂ ਹੀ ਕੁੜੀਆਂ ਵਿੱਚ ਖੇਡਣ ਵਾਲੀਆਂ ਖੇਡਾਂ ਗੁੱਡੀ ਪਟੋਲਾ ਗਿੱਟੇ ਖੇਡਣੇ ਪੀਚੋ ਬੱਕਰੀ ਆਦਿ ਹਨ ਇਸ ਇਸ ਨਾਲ ਹੀ ਸ਼ਹਿਰਾਂ ਵਿੱਚ ਵੀ ਸਕੂਲ ਤੋਂ ਹੀ ਖੇਡਾਂ ਖੇਡਣ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਵਿੱਚ ਕ੍ਰਿਕਟ ਫੁੱਟਬਾਲ ਬਾਸਕਿਟਬਾਲ ਬੈਡਮਿੰਟ ਆਦਿ ਖੇਡੀਆਂ ਜਾਂਦੀਆਂ ਹਨ ਇਸ ਲਈ ਖੇਡਾਂ ਦਾ ਸਾਡੇ ਜੀਵਨ ਵਿੱਚ ਹੋਣਾ ਬਹੁਤ ਜ਼ਰੂਰੀ ਹੈ